ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਤੁਸੀਂ ਜੀਓ ਕਸਟਮਰ ਕੇਅਰ ਨੰਬਰ ਤੋਂ ਬੋਲ ਰਹੇ ਹੋ ਹਾਂਜੀ ਮੈਮ ਮੈਂ ਨਾ ਤਰਨਪ੍ਰੀਤ ਸਿੰਘ ਬੋਲਦਾ ਜੀ ਪਿੰਡ ਕੋਟਲਾ ਟੱਪਰੀਆਂ ਤੋਂ ਐਕਚੁਲੀ ਨਾ ਪਰਸੋਂ ਮੈਂ ਰੀਚਾਰਜ ਕੀਤਾ ਸੀਗਾ ਆਪਣੇ ਇਸ ਨੰਬਰ 'ਤੇ ਸੈਵਨ ਨਾਈਨ ਸੈਵਨ ਥ੍ਰੀ ਫਾਈਵ ਟ੍ਰਿਪਲ ਸੈਵਨ ਫੋਰ ਥ੍ਰੀ 'ਤੇ ਹਾਂਜੀ ਮੈਮ ਹਾਂਜੀ ਇਹ ਨੰਬਰ ਮੇਰਾ ਹੀ ਹੈ ਮੈਂ ਇਸ ਨੰਬਰ 'ਤੇ ਰੀਚਾਰਜ ਕੀਤਾ ਸੀਗਾ ਪਰਸੋਂ ਸਾਢੇ ਕੁ ਬਾਰ੍ਹਾਂ ਵਜੇ ਦੇ ਨਾਲ ਮੈਮ ਐਕਚੁਲੀ ਮੈਨੂੰ ਨਾ ਕੋਈ ਸਕਸੈੱਸਫੁੱਲ ਦਾ ਮੈਸਿਜ ਨਹੀਂ ਆਇਆ ਅਮਾਊਂਟ ਮੇਰੇ ਅਕਾਊਂਟ 'ਚੋਂ ਕੱਟ ਗਈ ਹਾਂਜੀ ਮੈਮ ਥ੍ਰੀ ਫੋਰਟੀ ਨਾਈਨ ਵਾਲਾ ਇਹ ਪੈਕ ਸੀਗਾ ਇਸ ਵਿੱਚ ਮੈਨੂੰ ਇੱਕ ਮਹੀਨੇ ਦੀ ਅਨਲਿਮਟਡ ਕੌਲਜ ਸੀਗੀ ਅਨਲਿਮਟਡ ਮੈਸਿਜਸ ਸੀਗੇ ਹਾਂਜੀ ਡੇਲੀ ਦਾ ਡੇਢ ਜੀ ਬੀ ਡਾਟਾ ਸੀਗਾ ਹਾਂਜੀ ਮੈਮ ਮੈਂ ਡਾਟਾ ਤਾਂ ਯੂਜ ਕਰ ਪਾ ਰਿਹਾ ਹੈ ਨੈੱਟ ਮੇਰਾ ਚੱਲ ਰਿਹਾ ਪਰ ਕੋਲਿੰਗ ਨਹੀਂ ਹੋ ਰਹੀ ਮੈਮ ਹਾਂਜੀ ਕਿਰਪਾ ਚੈੱਕ ਕਰਕੇ ਮੈਨੂੰ ਦੱਸ ਦਿਉਂਗੇ ਤੁਸੀਂ ਕਦੋਂ ਤੱਕ ਇਹ ਪ੍ਰੋਬਲਮ ਸੋਲਵ ਹੋ ਜਾਵੇਗੀ ਮੇਰੀ ਹਾਂਜੀ ਮੈਮ ਨੈਟਵਰਕ ਇਸ਼ੂ ਨਹੀਂ ਹੈਗਾ ਕੋਈ ਵੀ ਨੈਟਵਰਕ ਤਾਂ ਠੀਕ ਹੈ ਜੀ ਹਾਂਜੀ ਮੈਮ ਕੋਲਿੰਗ ਸਿਮ ਨੰਬਰ ਵਨ ਤੋਂ ਰੀਚਾਰਜ ਹੈ ਵਨ 'ਚ ਹੀ ਹੈ ਮੇਰਾ ਸਿਮ ਐਕਚੁਲੀ ਪਾਇਆ ਹੋਇਆ ਇਹ ਮੈਂ ਹਾਂਜੀ ਠੀਕ ਹੈ ਓਕੇ ਮੈਮ